ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਕਰਨ ਲਈ ਸਭ ਤੋਂ ਪਹਿਲਾਂ ਕਦਮ ਤਾਂ ਇਹ ਹੈ ਕੀ ਸਕੂਲ ਲੈਵਲ ਤੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਵੇ ਉਸ ਤੋਂ ਬਾਅਦ ਸਰਕਾਰੀ ਦਫਤਰਾਂ ਅਦਾਰਿਆਂ ਵਿੱਚ ਸਭ ਸਾਰੇ ਕਿਤੇ ਪੰਜਾਬੀ ਵਰਤੀ ਜਾਵੇ ਮੁੱਖ ਰੂਪ ਵਿੱਚ ਪੰਜਾਬੀ ਪੰਜਾਬ ਵਿੱਚ ਪੰਜਾਬੀ ਚੱਲਣੀ ਚਾਹੀਦੀ ਹੈ ਸਾਰੇ ਸਰਕਾਰੀ ਦਫਤਰਾਂ ਅਦਾਰਿਆਂ ਵਿੱਚ ਪੰਜਾਬੀ ਚੱਲਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਜਿਨਾਂ ਦੇ ਬੱਚੇ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ ਇੰਗਲਿਸ਼ ਮੀਡੀਅਮ ਸਕੂਲਾਂ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕੀ ਆਪਣੇ ਪੱਧਰ 'ਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜਾਉਣ ਸਿਖਾਉਣ ਗੁਰਮੁਖੀ ਲਿਪੀ ਨਾਲ ਜੋੜਨ